ਮੈਂ ਸੁਨੀਲ ਕੁਮਾਰ ਮਿਰਜ਼ਾਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਦਿਨ ਮੈਂ ਆਪਣੇ ਦੋਸਤ ਘਰ ਗਿਆ ਅਤੇ ਉੱਥੇ ਜਾ ਕੇ ਮੈਂ ਉਹਨਾਂ ਦੇ ਕਿਚਨ ਰਸੋਈ ਦੇ ਵਿੱਚ ਚਲਾ ਗਿਆ ਅਤੇ ਰਸੋਈ ਵਿੱਚ ਜਾ ਕੇ ਉਹਨਾਂ ਦਾ ਇੱਕ ਵਾਟਰ ਕੂਲਰ ਸੀ ਜੋ ਕਿ ਪਾਣੀ ਲੀਕ ਕਰ ਰਿਹਾ ਸੀ ਅਤੇ ਮੈਂ ਆਪਣੇ ਦੋਸਤ ਨੂੰ ਪੁੱਛਿਆ ਯਾਰ ਤੇਰਾ ਵਾਟਰ ਕੁੱਲਰ ਲੀਕ ਹੋ ਰਿਹਾ ਅਤੇ ਤੂੰ ਵੀ ਇਸ ਵਾਰ ਦੇਖਿਆ ਨਹੀਂ ਇਸ ਨੂੰ ਨਹੀਂ ਦੇਖਿਆ ਤਾਂ ਫਿਰ ਮੈਂ ਉਹਨੂੰ ਇਹ ਸਮਝਾਇਆ ਕਿ ਯਾਰ ਜਲ ਹੀ ਸਰੋਤ ਹੈ ਪਾਣੀ ਤੁਹਾਨੂੰ ਪਤਾ ਹੀ ਹੈ ਬਹੁਤ ਮੁੱਲਵਾਨ ਚੀਜ਼ ਹੈ ਇਹਨੂੰ ਵਿਅਰਥ ਨਹੀਂ ਗਵਾਈਦਾ ਫਿਰ ਉਹ ਮੈਨੂੰ ਮੇਰਾ ਦੋਸਤ ਮੈਨੂੰ ਬੋਲਣ ਲੱਗ ਪਿਆ ਕਿ ਯਾਰ ਮੈਂ ਕਿ ਇਹ ਕਿ ਮੈਂ ਇਸਨੂੰ ਠੀਕ ਕਰਵਾ ਲੈਂਦਾ ਪਰ ਮੇਰਾ ਦੋਸਤ ਕਹਿਣ ਦੇ ਬਾਵਜੂਦ ਮੈਂ ਆਪਣੇ ਦੋਸਤ ਨੂੰ ਇਹ ਬੋਲਿਆ ਕਿ ਯਾਰ ਤੂੰ ਕਰਵਾ ਲਏਗਾ ਮੈਂ ਤੇਰਾ ਹੁਣੇ ਕਰਵਾਉਂਦਾ ਫਿਰ ਮੇਰਾ ਇੱਕ ਯਾਰ ਦੋ ਦੋਸਤ ਸੀ ਜੋ ਕਿ ਵਾਟਰ ਕੁਲਰ ਨੂੰ ਠੀਕ ਕਰਦਾ ਸੀ ਉਸ ਨੂੰ ਮੈ ਫੋਨ ਕੀਤਾ ਤਾਂ ਉਹ ਮੇਰੇ ਕੋਲ ਆਇਆ ਅਤੇ ਮੈਂ ਫਿਰ ਮੈਂ ਉਸ ਨੂੰ ਬੋਲਿਆ ਕਿ ਯਾਰ ਇਹਨਾਂ ਦਾ ਬਾਰਡਰ ਕੂਲਰ ਠੀਕ ਕਰਦੇ ਅਤੇ ਉਹ ਵਾਟਰਕੂਲਰ ਠੀਕ ਕਰਕੇ ਚਲਾ ਗਿਆ ਅਤੇ ਜੋ ਵੀ ਉਸਦੀ ਪੇਮੈਂਟ ਜਾਂ ਪੈਸੇ ਬਣਦੇ ਸੀ ਉਸਨੂੰ ਦੇ ਦਿੱਤੇ ਅਤੇ ਉਹ ਚਲ ਗਏ ਇਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਲ ਹੀ ਸਰੋਤ ਹੈ ਇਹਨਾਂ ਦੀ ਕਦਰ ਕਰੋ ਇਹਨਾਂ ਦੀ ਕਦਰ ਕਰੋ ਪਾਣੀ ਨੂੰ ਵਿਅਰਥ ਨਹੀਂ ਕਦੀ ਵੀ ਗੁਆਉਣਾ ਚਾਹੀਦਾ ਹਾਂਜੀ ਤਾਂ ਅੱਜ ਕੱਲ੍ਹ ਤਾਂ ਵੈਸੇ ਵੀ ਬੋਰਡ ਲੱਗੇ ਹੋਏ ਹੈ ਜਲ ਹੀ ਜੀਵਨ ਹੈ ਜਲ ਹੀ ਸਰੋਤ ਹੈ